ਮੈਂ ਕਦੇ ਕਿਸੇ ਹੋਰ ਭਾਸ਼ਾ ਦੀਆਂ ਕਿਤਾਬਾਂ ਜ਼ਿਆਦਾ ਤਾਂ ਨਹੀਂ ਪੜ੍ਹੀਆਂ ਪਰ ਇੱਕ ਹਿੰਦੀ ਦੀ ਕਿਤਾਬ ਪੜ੍ਹੀ ਸੀ ਜਿਸਦਾ ਨਾਮ ਸੀ ਖੂਬਸੂਰਤ ਵਾਦੀਆਂ ਅਤੇ ਉਸ ਤੋਂ ਇਲਾਵਾ ਇੱਕ ਇੰਗਲਿਸ਼ ਦੀ ਕਿਤਾਬ ਪੜ੍ਹੀ ਸੀ ਰਿਚ ਡੈਡ ਪੂਅਰ ਡੈਡ ਅਤੇ ਔਰ ਮੈਂ ਕੋਈ ਇਸ ਤੋਂ ਬਾਅਦ ਜ਼ਿਆਦਾ ਤਾਂ ਕਿਤਾਬਾਂ ਨਹੀਂ ਪੜ੍ਹੀਆਂ ਪਰ ਆਪਣੀ ਮੂਲ ਭਾਸ਼ਾ ਪੰਜਾਬੀ ਦੀਆਂ ਕਿਤਾਬਾਂ ਮੈਂ ਤਕਰੀਬਨ ਬਹੁਤ ਪੜ੍ਹ ਚੁੱਕਿਆ ਹਾਂ ਪੜ੍ਹਦਾ ਵੀ ਰਹਿੰਦਾ ਹਾਂ ਅਤੇ ਜਿਹੜੀ ਮੈਨੂੰ ਸਭ ਤੋਂ ਵਧੀਆ ਕਿਤਾਬਾਂ ਲੱਗੀਆਂ ਹਨ ਉਹਨਾਂ ਵਿੱਚੋਂ ਕੁਝ ਕਿਤਾਬਾਂ ਦਾ ਮੈਂ ਇੱਥੇ ਜ਼ਿਕਰ ਕਰਦਾ ਹਾਂ ਜਿਵੇਂ ਸਿੱਖ ਰਾਜ ਕਿਵੇਂ ਗਿਆ ਦੁਖੀਏ ਮਾਂ ਪੁੱਤ ਸੋਹਣ ਸਿੰਘ ਸ਼ੀਤਲ ਜੀ ਦੀ ਲਿਖੀ ਹੋਈ ਹੈ ਰਾਤ ਬਾਕੀ ਹੈ ਨਾਵਲ ਜਸਵੰਤ ਸਿੰਘ ਕਵਲ ਜੀ ਦਾ ਲਿਖਿਆ ਹੋਇਆ ਹੈ ਚਿੱਟਾ ਲਹੂ ਆਪਣੇ ਲਾਲ ਸਿੰਘ ਜੀ ਦਾ ਲਿਖਿਆ ਹੋਇਆ ਉਸ ਤੋਂ ਇਲਾਵਾ ਨਾਨਕ ਸਿੰਘ ਜੀ ਨੇ ਵੀ ਚਿੱਟਾ ਲਹੂ ਲਿਖਿਆ ਹੈ ਇੱਕ ਅਤੇ ਹੋਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਕਿਤਾਬਾਂ ਹਨ ਜਿਨ੍ਹਾਂ ਨੂੰ ਮੈਂ ਪੜ੍ਹਦਾ ਰਹਿੰਦਾ ਹਾਂ ਜ਼ਿਆਦਾਤਰ ਮੈਂ ਹਿਸਟੋਰੀਕਲ ਇਤਿਹਾਸਿਕ ਕਿਤਾਬਾਂ ਨੂੰ ਪਹਿਲ ਜ਼ਿਆਦਾ ਦਿੰਦਾ ਹਾਂ ਉਹ ਮੇਰੇ ਮਨ ਪਸੰਦ ਦੀਆਂ ਕਿਤਾਬਾਂ ਹਨ ਅਤੇ ਕਾਫੀ ਮਾਤਰਾ ਦੇ ਵਿੱਚ ਮੈਂ ਪੜ੍ਹ ਵੀ ਚੁੱਕਾ ਹਾਂ ਇਸ ਉੱਤੋਂ ਮੈਨੂੰ ਬਹੁਤ ਜਾਣਕਾਰੀ ਇਕੱਠੀ ਹੁੰਦੀ ਰਹਿੰਦੀ ਹੈ